ਸਤਿ ਸ਼੍ਰੀ ਅਕਾਲ ਜੀ ਮੈਂ ਦਿੱਲੀ ਤੋਂ ਗੱਲ ਕਰ ਰਹੀ ਹਾਂ ਜੀ ਮੇਰੀ ਸਹੇਲੀ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ ਸੀ ਅਤੇ ਅਸੀਂ ਮੋਹਾਲੀ ਘੁੰਮਣ ਆਉਂਣਾ ਹੈ ਮੋਹਾਲੀ ਵਿੱਚ ਕੁਝ ਘੁੰਮਣ ਦੇਖਣ ਫਿਰਨ ਘੁੰਮਣ ਫਿਰਨ ਲਈ ਕੁਝ ਹੈ ਵਧੀਆ ਹਾ ਹਾ ਹ ਠੀਕ ਹੈ ਜੀ ਹਾਂਜੀ ਹਾਂਜੀ

ਠੀਕ ਹੈ ਜੀ ਅਤੇ ਮਤਲਬ ਕੀ ਬੱਚਿਆਂ ਨੂੰ ਦਖਾਉਣ ਲਾਇਕ ਹੈ ਕੁਝ ਵਧੀਆ ਓਕੇ ਅੱਛਾ ਜੀ ਅਤੇ ਮਤਲਬ ਕੀ ਵਧੀਆ ਹੈ ਸਾਰਾ ਕੁਝ ਵੇਖਣ ਲਈ ਸ਼ੋਅਪਿੰਗ ਮੋਲ ਕਿੱਦਾਂ ਦੇ ਵੀ ਵਧੀਆ ਹੈ ਸ਼ੋਅਪਿੰਗ ਮੋਲ ਹਾਂਜੀ ਹਾ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਅਸੀਂ ਆਉਣ ਦਾ ਪਲੈਨ ਬਣਾਇਆ ਹੋਇਆ ਹੈ ਅਸੀਂ ਆਉਣਾ ਇੱਥੇ ਘੁੰਮਣ ਨੂੰ ਅਗਰ ਸਾਨੂੰ ਮਤਲਬ ਥੋਡੀ ਜ਼ਰੂਰਤ ਪਈ ਅਸੀਂ ਥੋਹਾਨੂੰ ਕੋਲ ਕਰਲਵਾਂਗੇ ਠੀਕ ਹੈ ਜੀ ਧੰਨਵਾਦ